ਮੈਨੂੰ ਸ਼ਿਵ ਕੁਮਾਰ ਬਟਾਲਵੀ ਦਾ ਮਹਾਂਕਾਵ ਲੂਣਾ ਜਿਹੜਾ ਹੈ ਉਹ ਬਹੁਤ ਪਸੰਦ ਹੈ ਕਿਉਂਕਿ ਸ਼ਿਵ ਕੁਮਾਰ ਨੇ ਇੱਕ ਮਰਦ ਲੇਖਕ ਹੋ ਕੇ ਉਸਦੇ ਵਿੱਚ ਇੱਕ ਔਰਤ ਲੂਣਾ ਦੀ ਕਹਾਣੀ ਬਿਆਨ ਕੀਤੀ ਹੈ ਅਤੇ ਇਸ ਮਿਥ ਨੂੰ ਵੀ ਤੋੜਿਆ ਕਿ ਜਿਹੜੀ ਲੂਣਾ ਸੀ ਉਹ ਮਤਰੇਈ ਮਾਂ ਹੋਣ ਕਰਕੇ ਮਤਲਬ ਉਹ ਚੰਗੀ ਨਹੀਂ ਸੀ ਸ਼ਿਵ ਕੁਮਾਰ ਨੇ ਇਸ ਦੇ ਵਿੱਚ ਦੱਸਿਆ ਵੀ ਸਲਵਾਨ ਜੋ ਲੂਣਾ ਦਾ ਪਤੀ ਸੀ ਉਸਦੇ ਪਿਤਾ ਦੀ ਉਮਰ ਦੇ ਬਰਾਬਰ ਸੀ ਅਤੇ ਜਿਵੇਂ ਕਿਹਾ ਜਾਂਦਾ ਵੀ ਲੂਣਾ ਜਿਹੜੀ ਹੈ ਉਹ ਸਲਮਾਨ ਦੇ ਪੁੱਤਰ ਪੂਰਨ ਦੇ ਉੱਪਰ ਮੋਹਿਤ ਹੋ ਗਈ ਸੀ ਜੋ ਉਸਦੀ ਉਮਰ ਦਾ ਲਗਭਗ ਹਾਣੀ ਸੀ ਤਾਂ ਉਹਦੇ ਵਿੱਚ ਸ਼ਿਵ ਕੁਮਾਰ ਨੇ ਕਿਹਾ ਵੀ ਲੂਣਾ ਜਿਹੜੀ ਹੈ ਉੱਥੇ ਚਰਿੱਤਰਹੀਣ ਨਹੀਂ ਸੀ ਜਿਵੇਂ ਉਹ ਲਿਖਦਾ ਵੀ ਚਰਿੱਤਰਹੀਣ ਤੇ ਤਾਂ ਕੋਈ ਆਖੇ ਜੇਕਰ ਲੂਣਾ ਵਿੱਚ ਹਾਸੇ ਤਾਂ ਉੱਥੇ ਉਹ ਕਹਿੰਦੀ ਵੀ ਲੂਣਾ ਜਿਹੜੀ ਉਹ ਤਾਂ ਉਸਦੀ ਰੂਹ ਤਾਂ ਕੰਜਕ ਹੈ ਇਹ ਤਾਂ ਮੈਂ ਹੀ ਜਾਣਦੀ ਹਾਂ ਇਸ ਤਰ੍ਹਾਂ ਸ਼ਿਵ ਕੁਮਾਰ ਦੀ ਇਹ ਪੁਸਤਕ ਲੂਣਾ ਜਿਹੜੀ ਹੈ ਉਹ ਮੈਨੂੰ ਬਹੁਤ ਪਸੰਦ ਹੈ ਉਹ ਸਾਡੇ ਜਿਹੜੇ ਇੱਕ ਮਿੱਥ ਹੈ ਵੀ ਮਤਰੇਈ ਮਾਂ ਚੰਗੀ ਨਹੀਂ ਹੁੰਦੀ ਉਸਨੂੰ ਵੀ ਤੋੜਦੀ ਹੈ ਅਤੇ ਲੂਣਾ ਦੇ ਸੱਚ ਨੂੰ ਪੇਸ਼ ਕਰਦੀ ਹੈ ਇਸ ਤੋਂ ਮੈਨੂੰ ਇਹ ਸਮਝ ਆਈ ਮੈਨੂੰ ਇਹ ਸਿੱਖਿਆ ਵੀ ਮਿਲੀ ਕਿ ਜਿਹੜੇ ਪੁਰਸ਼ ਲੇਖਕ ਨੇ ਉਹ ਵੀ ਇੱਕ ਇਸਤਰੀ ਦੇ ਦਰਦ ਨੂੰ ਸਮਝ ਸਕਦੇ ਨੇ ਉਸਨੂੰ ਬਿਆਨ ਕਰ ਸਕਦੇ ਨੇ ਅਤੇ ਇਹ ਵੀ ਪਤਾ ਲੱਗਿਆ ਕਿ ਇੱਕ ਔਰਤ ਦੇ ਲਈ ਉਸਦੇ ਪਤੀ ਦਾ ਉਸਦਾ ਹਾਣੀ ਹੋਣਾ ਬਹੁਤ ਜ਼ਰੂਰੀ ਹੈ ਉਹ ਹਾਣੀ ਉਮਰਾਂ ਦਾ ਵੀ ਹੋਣਾ ਚਾਹੀਦਾ ਉਹ ਹਾਣੀ ਜਿਹੜਾ ਵਿਚਾਰਾਂ ਦਾ ਵੀ ਹੋਣਾ ਚਾਹੀਦਾ